ਪੰਜਾਬੀ ਸਿੱਖ ਪਰਿਵਾਰਾਂ ਵਿੱਚ ਵਿਆਹ ਬਹੁਤ ਹੀ ਰਸਮ ਰਿਵਾਜ਼ ਨਾਲ ਕੀਤੇ ਜਾਂਦੇ ਹਨ ਸਾਰੀਆਂ ਰਸਮਾਂ ਦਾ ਆਪਣਾ ਆਪਣਾ ਹੀ ਮਹੱਤਵ ਹੁੰਦਾ ਹੈ ਹਰ ਰਸਮ ਦੇ ਅਰਥ ਹੁੰਦੇ ਹਨ ਜਿਵੇਂ ਕਿ ਲੜਕੇ ਜਾਂ ਲੜਕੀ ਦਾ ਵਿਆਹ ਉਹਦੇ ਵਿੱਚ ਥੋੜ੍ਹੇ ਥੋੜ੍ਹੇ ਜਿਹੜੇ ਆ ਰਸਮਾਂ 'ਚ ਫਰਕ ਹੁੰਦਾ ਹੈ ਜਿਵੇਂ ਕਿ ਲੜਕੇ ਦੇ ਵਿਆਹ ਸਮੇਂ ਅਸੀਂ ਬਰਾਤ ਚੜ੍ਹਾਉਂਦੇ ਹਾਂ ਜਿਹਦੇ ਵਿੱਚ ਰਸਮ ਆ ਜਾਂਦੀ ਹੈ ਸੁਰਮਾ ਪੁਆਈ ਜੋ ਕਿ ਮੁੰਡੇ ਦੀ ਭਰਜਾਈ ਬੰਨਿਓ ਕੀਤੀ ਜਾਂਦੀ ਹੈ ਅਤੇ ਇਸ ਦੇ ਬਦਲੇ ਮੁੰਡਾ ਉਸ ਨੂੰ ਕੁਛ ਸ਼ਗਨ ਦੇ ਰੂਪ ਵਿੱਚ ਪੈਸੇ ਗਹਿਣੇ ਦਿੰਦਾ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਲਈਏ ਸ਼ੇਰੇਬੰਦੀ ਦੀ ਰਸਮ ਜੋ ਭੈਣਾਂ ਵੰਨੀਓ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਬਰਾਤ ਚੜ੍ਹਾਈ ਜਾਂਦੀ ਹੈ ਇਸ ਤੋਂ ਅੱਗੇ ਫਿਰ ਆਨੰਦ ਕਾਰਜ ਕੀਤਾ ਜਾਂਦਾ ਹੈ ਜਿਸ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚਾਰ ਲਾਵਾਂ ਲੈ ਕੇ ਪੂਰੀ ਕੀਤੀ ਜਾਂਦੀ ਹੈ ਅਤੇ ਅਰਦਾਸ ਹੁੰਦੀ ਹੈ ਅਤੇ ਇੱਕ ਦੂਜੇ ਦਾ ਜਿਹੜਾ ਲੜ ਫੜਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਜਦੋਂ ਡੋਲੀ ਘਰ ਵਾਪਸ ਆਉਂਦੀ ਹੈ ਤਾਂ ਲੜਕੇ ਦੀ ਮਾਂ ਜਿਹੜੀ ਆ ਉਹ ਆਪਣੇ ਬੱਚਿਆਂ ਤੋਂ ਪਾਣੀ ਵਾਰ ਕੇ ਪੀਂਦੀ ਹੈ ਜਿਸ ਦਾ ਅਰਥ ਇਹ ਹੁੰਦਾ ਹੈ ਕਿ ਮੇਰੇ ਬੱਚੇ 'ਤੇ ਜੋ ਵੀ ਬੁਰੀਆਂ ਬਲਾਵਾਂ ਜਾਂ ਬੁਰਾ ਸਮਾਂ ਨਾ ਆਵੇ ਉਸਦੇ ਬਦਲੇ ਉਹ ਸਾਰਾ ਜਿਹੜਾ ਵੀ ਦੁੱਖ ਤਕਲੀਫ ਆ ਉਹ ਮੁੰਡੇ ਦੀ ਮਾਂ ਚਾਹੁੰਦੀ ਹੈ ਕਿ ਉਹ ਪਰਮਾਤਮਾ ਮੈਨੂੰ ਦੇਵੇ ਮੇਰੇ ਬੱਚਿਆਂ 'ਤੇ ਨਾ ਆਵੇ ਉਸ ਤੋਂ ਨੈਕਸਟ ਫਿਰ ਅਗਲੇ ਦਿਨ ਮੱਥਾ ਟੇਕਣ ਲਈ ਜਿਸ ਤਰ੍ਹਾਂ ਦੀ ਵੀ ਮਰਿਆਦਾ ਹੁੰਦੀ ਹੈ ਉਸ ਦੇ ਅਕੋਰਡਿੰਗ ਮੱਥਾ ਟੇਕਿਆ ਜਾਂਦਾ ਹੈ ਅਤੇ ਛਟੀਆਂ ਖਿਡਾਈ ਜਾਂਦੀਆਂ ਨੇ ਲੜਕਾ ਲੜਕੀ ਦੇ ਸੱਤ ਸੱਤ ਛਟੀਆਂ ਮਾਰਦੇ ਹਨ ਅਤੇ ਰਿਸ਼ਤੇਦਾਰ ਵੀ ਇਹ ਰਸਮ ਨੂੰ ਪੂਰੀ ਖੁਸ਼ੀ ਨਾਲ ਪੂਰੇ ਅੱਛੇ ਤਰੀਕੇ ਨਾਲ ਕਰਦੇ ਹਨ ਅਤੇ ਇਹਦੇ ਵਿੱਚ ਬਹੁਤ ਹਾਸੀ ਮਜ਼ਾਕ ਵੀ ਹੁੰਦਾ ਹੈ